ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਮੈਂ ਤੁਹਾਡੇ ਕੋਲ ਲੈਦਰ ਦੀ ਜੈਕਟ ਆਡਰ ਕਰਾਈ ਸੀ ਅਤੇ ਉਹ ਮੈਨੂੰ ਬਹੁਤ ਵਧੀਆ ਮਿਲੀ ਆ ਅਤੇ ਇਹ ਜਾਣ ਕੇ ਮੈਨੂੰ ਖੁਸ਼ੀ ਹੋਈ ਆ ਕਿ ਜਿੱਦਾਂ ਦੀ ਮੈਂ ਜੈਕਟ ਆਡਰ ਕਰਾਈ ਸੀ ਅਤੇ ਉਹ ਸੇਮ ਟੂ ਸੇਮ ਉਦਾਂ ਦੀ ਹੀ ਆਈ ਆ ਅਤੇ ਮੈਨੂੰ ਇਹ ਵੀ ਜਾਣ ਕੇ ਬਹੁਤ ਖੁਸ਼ੀ ਹੋਈ ਆ ਕਿ ਮੈਂ ਬਾਰਾਂ ਤਰੀਕ ਦੀ ਆਡਰ ਕਰੀ ਸੀ ਅਤੇ ਉਹ ਜੈਕਟ ਮੈਨੂੰ ਗਿਆਰਾਂ ਤਾਰੀਕ ਨੂੰ ਡਿਲੀਵਰ ਹੋ ਗਈ ਆ ਮੈਂ ਇੰਨੀ ਫਾਸਟ ਡਿਲਿਵਰੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਜਦੋਂ ਮੈਂ ਜੈਕਟ ਓਪਨ ਕੀਤੀ ਤਾਂ ਉਦਿਆ ਸੇਮ ਟੂ ਸੇਮ ਜਿੱਦਾਂ ਮੈਂ ਕਲਰ ਬੁਕਿੰਗ ਕਰਵਾਇਆ ਸੀ ਸੇਮ ਟੂ ਸੇਮ ਕਲਰ ਸੀ ਮੈਂ ਬ੍ਰਾਉਨ ਕਲਰ ਮੰਗਵਾਇਆ ਸੀ ਅਤੇ ਉਹ ਸੇਮ ਟੂ ਸੇਮ ਬ੍ਰਾਉਨ ਸੀ ਅਤੇ ਉਹਦੇ ਫਰ ਵੀ ਮੋਟੇ ਸੀ ਅਤੇ ਉਹ ਮੋਟੀ ਲੈਦਰ ਸੀ ਅਤੇ ਅ ਮੈਂ ਉਹਨੂੰ ਉਹ ਜਿਹੜੇ ਕਲਰ ਸੀ ਉਹ ਮੇਰੇ 'ਤੇ ਬਹੁਤ ਜ਼ਿਆਦਾ ਫਬਦਾ ਪਿਆ ਸੀ ਜ਼ਿਤੇ ਮੈਂ ਜਦੋਂ ਬਾਹਰ ਪਾ ਕੇ ਗਈ ਅਤੇ ਮੇ ਮਤਲਬ ਸਭ ਮੇਰੀ ਫਰੈਂਡਸ ਜੋ ਸਾਰਿਆਂ ਨੂੰ ਬਹੁਤ ਪਸੰਦ ਆਇਆ ਅਤੇ ਮੈਂ ਕੋਲਜ ਵਿੱਚ ਵੀ ਪਾ ਕੇ ਗਈ ਸੀ ਅਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਉਹ ਜੈਕਟ ਪਸੰਦ ਆਈ ਅਤੇ ਮੈਂ ਹੁਣ ਇਹ ਜਾਣ ਕੇ ਮੈਨੂੰ ਬਹੁ ਉਹਨਾਂ ਨੂੰ ਬਹੁਤ ਜਾ ਉਹਨਾਂ ਨੂੰ ਮੈਂ ਦੱਸਿਆ ਕਿ ਇਹ ਜਿਹੜੀ ਜੈਕਟ ਮੈਂ ਮੰਗਵਾਈ ਆ ਇਹ ਮੈਂ ਆਨਲਾਈਨ ਮੰਗਵਾਈ ਆ ਅਤੇ ਉਹਨਾਂ ਨੇ ਇਹਦਾ ਕਲਰ ਬੜਾ ਪਸੰਦ ਕੀਤਾ ਅਤੇ ਹੁਣ ਉਹਨਾਂ ਨੇ ਵੀ ਇੱਥੋਂ ਤੁਹਾਡੇ ਕੋਲ ਓਡਰ ਕਰਾਉਣੀ ਆ ਅਤੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੀ ਸੇਮ ਟੂ ਸੇਮ ਜੈਕਟ ਮਿਲੇ ਅਤੇ ਸੇਮ ਟੂ ਸੇਮ ਤੁਹਾਡੇ ਕੋਲ ਜੈਕਟ ਮਿਲੇ ਅਤੇ ਮੈਂ ਅਗਲੀ ਵਾਰੀ ਵੀ ਤੁਹਾਡੇ ਕੋਲ ਹੀ ਸ਼ੋਪਿੰਗ ਕਰਨੀ ਆ ਧੰਨਵਾਦ